ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਨਹੀਂ ਨਹੀਂ ਜੀ ਕੋਈ ਇਮਪੋਰਟੈਂਟ ਵਰਕ ਦੀ ਤਾਂ ਚੱਲੋ ਕੋਈ ਗੱਲ ਨਹੀਂ ਹੈਗੀ ਜੀ ਜੇ ਬਿਮਾਰ ਸੀ ਕੋਈ ਗੱਲ ਨਹੀਂ ਤੁਸੀਂ ਭੇਜਿਆ ਨਹੀਂ ਹੈਗਾ ਸਹੀ ਕੀਤਾ ਜੀ ਤੁਸੀਂ ਦਵਾਈ ਵਗੈਰਾ ਦਵਾ ਦਿਓ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਬਸ ਦਵਾਈ ਦਵਾ ਦਿਓ ਜੀ ਜਿਹੜੇ ਵੀ ਕੋਈ ਨੋਟਸ ਵਗੈਰਾ ਹੋਣਗੇ ਮੈਂ ਕੱਲ੍ਹ ਨੂੰ ਪ੍ਰੋਵਾਈਡ ਕਰਵਾ ਦਉ ਜਾਂ ਤੁਹਾਨੂੰ ਮੈਂ ਮੇਲ ਵਗੈਰਾ ਕਰ ਦਉਂਗਾ ਜੀ ਤੁਸੀਂ ਉਹ ਜਦੋਂ ਠੀਕ ਹੋ ਗਈ ਉਦੋਂ ਉਹਨਾਂ ਨੂੰ ਪੜ੍ਹਾ ਦਿਓ ਜੀ ਹੋਮ ਵਰਕ ਵਗੈਰਾ ਹੋਵੇਗਾ ਹਾਂ ਹਾਂਜੀ ਹਾਂਜੀ ਉਹ ਵੀ ਰਿਟਨ 'ਚ ਵੀ ਭੇਜ ਦਿਓ ਜੀ ਉਹ ਰਿਕੋਰਡ 'ਚ ਰਹਿ ਜਾਂਦੀ ਹੈ ਸਾਡੇ ਹਾਂਜੀ ਨਹੀਂ ਨਹੀਂ ਜੀ ਉੱਦਾਂ ਪਰਫੋਰਮੈਂਸ ਸਟੂਡੈਂਟ ਦੀ ਠੀਕ ਹੈ ਜੀ ਬਾਕੀ ਸਪੋਰਟਸ ਦੇ ਵਿੱਚ ਵੀ ਸਹੀ ਹੈ ਜੀ ਸਾਰੀਆਂ ਹੋਰ ਐਕਟੀਵਿਟੀਜ ਦੇ ਵਿੱਚ ਸਟਡੀ ਤੋਂ ਇਲਾਵਾ ਸਾਰੇ ਵਿੱਚ ਠੀਕ ਹੈ ਜੀ ਬਾਕੀ ਤੁਸੀਂ ਚੱਲੋ ਹੁਣ ਮੌਸਮ ਖਰਾਬ ਹੋ ਰਿਹਾ ਜੀ ਠੰਡ ਵਗੈਰਾ ਹੋ ਰਹੀ ਹੈ ਨਾ ਤੁਸੀਂ ਧਿਆਨ ਰੱਖਿਓ ਥੋੜ੍ਹਾ ਜਿਹਾ ਨਾ ਦਵਾਈ ਵਗੈਰਾ ਵਧੀਆ ਦਵਾ ਦਿਉ ਟੈਸਟ ਵਗੈਰਾ ਕਰਵਾ ਦਿਓ ਹਾਂਜੀ ਹਾਂਜੀ ਉਹ ਨੈਕਸਟ ਸੈਟਰਡੇ ਆ ਤੁਹਾਨੂੰ ਮੇਲ ਆਉਗੀ ਅਸੀਂ ਮੇਲ ਕਰਕੇ ਤੁਹਾਨੂੰ ਇੰਟੀਮੇਟ ਕਰ ਦੇਵਾਂਗੇ ਹਾਂਜੀ ਨਹੀਂ ਫਿਲਹਾਲ ਤਾਂ ਕੋਈ ਨਹੀਂ ਹੈਗੀ ਬਸ ਤੁਸੀਂ ਸਟੂਡੈਂਟਸ ਦਾ ਧਿਆਨ ਰੱਖਿਆ ਕਰੋ ਹੈ ਨਾ ਹਾਂਜੀ ਫੇਰ ਦਵਾਈ ਵਗੈਰਾ ਦਵਾ ਦਿਓ ਜੀ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਧਿਆਨ ਰਖੂੰਗਾ ਜੀ ਕੋਈ ਗੱਲ ਨਹੀਂ ਜੀ ਨਾ ਹਾਂਜੀ ਓਕੇ ਜੀ ਚੱਲੋ ਜੀ ਹੈ ਨਾ ਜੀ ਤੁਸੀਂ ਦਵਾਈ ਵਗੈਰਾ ਦਵਾ ਦਿਉ ਜੀ ਦੇਖ ਲਵਾਂਗੇ ਓ ਹਾਂਜੀ ਹਾਂਜੀ ਹਾਂਜੀ ਓਕੇ ਜੀ